ਪੰਜਾਬੀ ਕਿਸਾਨ ਬਿਜਾਈ ਦੇ ਮੌਸਮ ਦੀ ਤਿਆਰੀ ਕਈ ਤਰੀਕੇ ਨਾਲ ਕਰਦੇ ਹਨ ਇਹਨਾਂ ਦੇ ਮੁੱਖ ਕੰਮ ਸਿੱਖਿਆ ਹੁੰਦੀ ਹੈ ਕਿ ਇਸ ਕਿਸ ਮੌਸਮ ਵਿੱਚ ਕਿਉਂਕਿ ਕੰਮ ਕਰਨ ਲੋੜ ਹੈ ਜਿਵੇਂ ਬੀਜ ਦੇਣ ਲੋੜ ਹਨ ਅਤੇ ਕਿਵੇਂ ਸਕਾਬੀ ਅਤੇ ਬਾਰਿਸ਼ ਹੀ ਦੇ ਬਾਰੇ ਭਵਿੱਖਤਾ ਦੀ ਚਿੰਤਾ ਕਰਨੀ ਹੈ ਕਿਸਾਨ ਆਪਣੀ ਜ਼ਮੀਨ ਨੂੰ ਤਿਆਰ ਕਰਦਾ ਹੈ ਅਤੇ ਕਿਰਸਾਨੀ ਔਜ਼ਾਰ ਅਤੇ ਸ਼੍ਰੇਣੀਆਂ ਦੀ ਚੋਣ ਕਰਦਾ ਹੈ ਜਿਨ੍ਹਾਂ ਵਿੱ ਵਿੱਚ ਬੀਜ ਖਾਦ ਅਤੇ ਵਿਕਰਨ ਤਰੀਕੇ ਸ਼ਾਮਿਲ ਹੁੰਦੇ ਹਨ ਕਿਸਾਨ ਆਪਣੇ ਮੌਸਮੀ ਕੈਲੰਡਰ ਅਨੁਸਾਰ ਕਿਰਸਾਨੀ ਕੰਮ ਕਰਨ ਦਾ ਸਮਰਥਨ ਕਰਦਾ ਹੈ ਅਤੇ ਤੇਜ਼ੀ ਨਾਲ ਅਤੇ ਜਿਵੇਂ ਵੀ ਮੌ ਜਿਵੇਂ ਹੀ ਮੌਸਮ ਅਤੇ ਭਵਿੱਖਤਾ ਦੀ ਚਿੰਤਾ ਹੁੰਦੀ ਹੈ ਉਹਨਾਂ ਨੇ ਤਿਆਰੀ ਕਰ ਦਿੱਤੀ ਹੈ ਅਤੇ ਆਪਣੇ ਕਿਰਸਾਨੀ ਕਿਸਾਨੀ ਯੋਜਨਾ ਨੂੰ ਸੁਧਾਰਨ ਲਈ ਉਪਾਏ ਵਰਤਿਆ ਜਾਂਦਾ ਹੈ